ਹਾਂਜੀ ਪ੍ਰੋਫੈਸਰ ਹਰਮਨਪ੍ਰੀਤ ਸਿੰਘ ਗੱਲ ਕਰਨ ਰਹੇ ਨੇ ਪੰਜਾਬੀ ਯੂਨਿਵਰਸਿਟੀ ਪਟਿਆਲਾ ਤੋਂ ਜੀ ਹਾਂਜੀ ਸਰ ਮੈਂ ਪ੍ਰਭਜੋਤ ਸਿੰਘ ਬੋਲ ਰਿਹਾ ਜੀ ਮੇਰੇ ਮੈਂ ਨਾ ਜੀ ਇਥੋਂ ਘੱਗੇ ਤੋਂ ਬੋਲ ਰਿਹਾ ਜੀ ਸਰਕਾਰੀ ਕਿਰਤੀ ਕਾਲਜ ਨਿਆਲ਼ਿਆ ਨੇ ਜੀ ਇੱਥੇ ਪਾਤੜਾਂ ਜੀ ਉੱਥੋਂ ਮੈਂ ਬੀਏ ਕੀਤੀ ਹੈ ਜੀ ਅਤੇ ਮੇਰੇ ਟੀਚਰ ਨੇ ਪ੍ਰੋਫੈਸਰ ਜਸਵਿੰਦਰ ਸ਼ਰਮਾ ਉਹਨਾਂ ਨੂੰ ਮੈਂ ਮੈਂ ਕਿਹਾ ਸੀਗਾ ਵੀ ਮੈਂ ਯੂਨੀਵਰਸਿਟੀ ਅੱਗੇ ਐੱਮਏ ਕਰਨੀ ਐਂ ਇੱਥੋਂ ਮੈਂ ਬੀਏ ਕੀਤੀ ਹੋਈ ਅਤੇ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਸੀ ਮੈਨੂੰ ਕਹਿੰਦੇ ਵੀ ਇਹਨਾਂ ਨਾਲ ਗੱਲ ਕਰ ਲਉ ਵੀ ਉੱਥੇ ਪ੍ਰੋਫੈਸਰ ਨੇ ਰਾਜਨੀਤੀ ਸ਼ਾਸਤਰ ਦੇ ਮੈਂ ਹੁਣ ਮ ਐੱਮਏ ਕਰ ਸਬਜੈਕਟ ਸਰ ਮੇਰੇ ਕੋਲ ਮੇਰੇ ਕੋਲ ਪੋਲੀਟੀਕਲ ਸਾਇੰਸ ਸੀ ਜੀ ਪੰਜਾਬੀ ਲਿਟਰੇਚਰ ਅਤੇ ਫਿਜੀਕਲ ਐਜੂਕੇਸ਼ਨ ਬਾਕੀ ਇੰਗਲਿਸ਼ ਪੰਜਾਬੀ ਕੰਪਲਸਰੀ ਜੀ ਇੰਟਰਸਟ ਮੇਰਾ ਦੋਵਾਂ 'ਚ ਜ਼ਿਆਦਾ ਆ ਜੀ ਪੋਲੀਟੀਕਲ ਸਾਇੰਸ 'ਚ ਅਤੇ ਲਿਟਰੇਚਰ 'ਚ ਜੀ ਹਾਂਜੀ ਹਾਂਜੀ

ਮੇਰੇ ਪਚਵੰ ਪਚਵੰਜਾ ਪ੍ਰਸੈਂਟ ਨੇ ਜੀ ਨੰਬਰ

ਜੀ ਜੀ ਜੀ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਹਾਂਜੀ ਹਾਂਜੀ ਸਰ ਮੈਂ ਦੋਨਾਂ 'ਚ ਹੀ ਦੋਨਾਂ 'ਚ ਹੀ ਅਪਲਾਈ ਕਰ ਦੇਣਾ ਜਿਹ 'ਚ ਨੰਬਰ ਆ ਗਿਆ ਆਪਾਂ ਉਹ ਕਰ ਲਵਾਂਗੇ ਜੀ ਫਿਰ ਹੋਰ ਕੀ ਆ ਲਓ ਮੈਂ ਹਾਂਜੀ ਹਾਂਜੀ ਠੀ ਠੀਕ ਹੈ ਸਰ ਠੀਕ ਹੈ ਥੈਂਕ ਯੂ ਸਰ ਠੀਕ ਹੈ ਜੀ ਥੈਂਕ ਯੂ ਸਰ